ਹਾਂ ਸਭ ਤੋਂ ਪਹਿਲਾਂ ਕੁੱਕਰ ਜੋ ਸਬਜ਼ੀ ਬਣਾਉਣ ਦੇ ਕੰਮ ਆਉਂਦਾ ਹੈ ਗਰਾਸ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਕੌਲੀ ਸਬਜ਼ੀ ਭਾਜੀ ਪਾਈ ਜਾਂਦੀ ਹੈ ਇਹਦੇ ਵਿੱਚ ਥਾਲ ਜਿਸ ਵਿੱਚ ਰੋਟੀ ਰੱਖ ਕੇ ਖਾਧੀ ਜਾਂਦੀ ਹੈ ਪ੍ਰਾਂਤ ਜਿਸ ਵਿੱਚ ਆਟਾ ਗੁੰਨਿਆ ਜਾਂਦਾ ਹੈ